ਹੈਲੋ ਸਤਿ ਸ਼੍ਰੀ ਅਕਾਲ ਹਾਂਜੀ ਸਤਿ ਸ਼੍ਰੀ ਅਕਾਲ ਮੈਂ ਮੰਨਤ ਬੋਲਦੀ ਹਾਂ ਹਾਂਜੀ ਪਹਿਲਾਂ ਤਾਂ ਤੁਹਾਡਾ ਨਾਮ ਕੀ ਆ ਅਤੇ ਤੁਸੀਂ ਅਤੇ ਕਿੰਨੇ ਕੁ ਜਣਿਆਂ ਨੇ ਆਉਣਾ ਵਾ ਅਤੇ ਕਦੋਂ ਦਾ ਪਲੈਨ ਹੈ ਤੁਹਾਡਾ ਹਾਂਜੀ ਤੁਸੀਂ ਕਪੂਰਥਲਾ ਜਿੱਦਾਂ ਕਿੱਦਾਂ ਦੀ ਜਗ੍ਹਾ ਤੇ ਘੁੰਮਣਾ ਚਾਹੁੰਦੇ ਹੋ ਇਥੋਂ ਦੇ ਗੁਰਦੁਆਰੇ ਮੰਦਰ ਜਾ ਤੁਸੀਂ ਉੱਦਾਂ ਸਿਟੀ ਦੇਖਣਾ ਚਾਹੁੰਦੇ ਹੋ ਸਾਡੀ ਹਾਂਜੀ ਫਿਰ ਇੱਥੇ ਤਾਂ ਸਭ ਤੋਂ ਜਿਹੜਾ ਸਾਡਾ ਸਭ ਤੋਂ ਪ੍ਰਸਿੱਧ ਗੁਰਦੁਆਰਾ ਵਾ ਉਹ ਸਟੇਟ ਗੁਰਦੁਆਰਾ ਵਾ ਉਹ ਉੱਨੀ ਸੌ ਪੰਦਰਾਂ ਦਾ ਬਣਿਆ ਹੋਇਆ ਵਾ ਅਤੇ ਉਹਦੇ ਪਿੱਛੇ ਇੱਕ ਬਹੁਤ ਵੱਡੀ ਪਾਰਕ ਵੀ ਆ ਲੋਕੀ ਆਉਂਦੇ ਉੱਥੇ ਸੈਰ ਕਰਦੇ ਆ ਅਤੇ ਤੁਸੀਂ ਰਹਿਣਾ ਵੀ ਚਾਹੋਗੇ ਜੇ ਤੁਸੀਂ ਇੱਕ ਦਿਨ ਵਾਸਤੇ ਆਉਂਦੇ ਪਏ ਹੋ ਹਾਂਜੀ ਗੁਰਦਵਾਰੇ ਦੇ ਵਿੱਚ ਹੀ ਸਰਾਵਾਂ ਬਣੀਆਂ ਹੋਈਆਂ ਵਾਂ ਔਰ ਉੱਥੇ ਕੋਈ ਫੀਸ ਵੀ ਨਹੀਂ ਲੱਗਦੀ ਉੱਥੇ ਤੁਸੀਂ ਰਹਿ ਸਕਦੇ ਹੋ ਪਰ ਤੁਹਾਨੂੰ ਉਹਦੇ ਲਈ ਰਜਿਸਟ੍ਰੇਸ਼ਨ ਕਰਨੀ ਪਊਗੀ ਉਹ ਮੈਂ ਤੁਹਾਡੀ ਕਰਾ ਸਕਦੀ ਆ

ਕਪੂਰਥਲਾ ਸਿਟੀ ਦੇ ਬਿਲਕੁਲ ਵਿਚਕਾਰ ਬਿਲਕੁਲ ਸੈਂਟਰ 'ਚ ਸਥਿਤ ਵਾ ਔਰ ਬਹੁਤ ਈਜ਼ੀ ਆ ਉੱਥੇ ਜਾਣਾ ਉਹਦਾ ਬੰਦੋਬਸਤ ਮੈਂ ਤੁਹਾਡੇ ਨਾਲ ਕਰਾ ਦੂੰਗੀ ਤੁਸੀਂ ਗੁਰਦੁਆਰੇ ਦੇ ਇਲਾਵਾ ਇੱਥੇ ਮਾਤਾ ਭੱਧਰ ਕਾਲੀ ਮੰਦਰ ਵੀ ਬਹੁਤ ਜ਼ਿਆਦਾ ਮਸ਼ਹੂਰ ਆ ਜੋ ਕਿ ਸ਼ੇਖੂਪੁਰ ਦੇ ਵਿੱਚ ਆ ਉਹ ਕਪੂਰਥਲੇ ਤੋਂ ਥੋੜ੍ਹਾ ਜਿਹਾ ਅੱਗੇ ਪੈ ਜਾਂਦਾ ਵਾ ਸਿਟੀ ਦੇ ਵਿੱਚ ਉਹਦੇ ਇਲਾਵਾ ਪੰਚ ਮੰਦਰ ਵੀ ਆ ਅਤੇ ਸੱਤ ਨਰਾਇਣ ਮੰਦਰ ਵੀ ਹੈਗਾ ਇਥੇ ਹਾਂਜੀ ਮੇਰਾ ਇਕ ਦਿਨ ਦਾ ਇੱਕ ਬੰਦੇ ਵਾਸਤੇ ਹਜ਼ਾਰ ਰੁਪਏ ਆ ਅਤੇ ਜਿੱਦਾਂ ਤੁਸੀਂ ਕਿਹਾ ਤੁਸੀਂ ਤੁਹਾਡੀ ਸਹੇਲੀ ਆਉਂਦੀ ਪਈ ਆ ਅਤੇ ਫਿਰ ਇੱਕ ਦਿਨ ਦਾ ਦੋ ਹਜ਼ਾਰ ਹੁੰਦਾ ਵਾ ਕਿਉਂਕਿ ਨਾਲੋਂ ਨਾਲ ਅਸੀਂ ਤੁਹਾਡੇ ਬਾਕੀ ਗੱਡੀ ਦਾ ਵੀ ਖਰਚਾ ਸਾਡਾ ਹੀ ਹੁੰਦਾ ਸਾਰਾ ਹਾਂਜੀ ਕਪੂਰਥਲਾ ਦਾ ਖਾਣਾ ਬਹੁਤ ਜਿਆਦਾ ਮਸ਼ਹੂਰ ਆ ਇੱਥੇ ਤੁਹਾਨੂੰ ਹਰ ਤਰਾਂ ਦਾ ਖਾਣਾ ਜਿੱਦਾਂ ਦਾ ਵੀ ਤੁਸੀਂ ਖਾਣਾ ਪਸੰਦ ਕਰਦੇ ਹੋ ਫਾਸਟ ਫੂਡ ਹੋ ਜਾਏ ਜਾਂ ਇੱਥੋਂ ਦੇ ਲੋਕਲ ਬੜੇ ਫੇਮਸ ਫੇਮਸ ਜਿਹੜੇ ਖਾਣੇ ਹੁੰਦੇ ਆ ਛੋਲੇ ਕੁਲਚੇ ਸਾਰਾ ਕੁਝ ਤੁਹਾਨੂੰ ਆਰਾਮ ਨਾਲ ਕਪੂਰਥਲਾ ਦੇ ਵਿੱਚ ਹੀ ਮਿਲ ਜਾਂਦਾ ਵਾ

ਹਾਂਜੀ ਕਪੂਰਥਲਾ ਹਾਂਜੀ ਕ ਕਪੂਰਥਲਾ ਦਾ ਸਭ ਤੋਂ ਮਸ਼ਹੂਰ ਔਰ ਸਭ ਤੋਂ ਪੁਰਾਣਾ ਗੁਰਦੁਆਰਾ ਜੋ ਕਿ ਸਾਡਾ ਗੁਰਦੁਆਰਾ ਬੇਰ ਸਾਹਿਬ ਆ ਅਤੇ ਬਾਬਾ ਗੁਰੂ ਨਾਨਕ ਦੇਵ ਜੀ ਦੇ ਕਰਕੇ ਬਣਿਆ ਵਾ ਇੱਥੇ ਬਾਬਾ ਜੀ ਇੱਕ ਟਾਈਮ 'ਤੇ ਰਹਿਣ ਆਏ ਸੀ ਔਰ ਉੱਥੇ ਹਮਜ਼ਾ ਗੋਸ ਜੀ ਨੂੰ ਮਿਲੇ ਸੀਗੇ ਜੋ ਕੀ ਇੱਕ ਬਹੁਤ ਹੀ ਪੁਰਾਣੇ ਸੇਂਟ ਆ ਇਹ ਬਹੁਤ ਜ਼ਿਆਦਾ ਧਾਰਮਿਕ ਮੰਨਿਆ ਜਾਂਦਾ ਲੋਕਾਂ ਵਿੱਚ ਸੁਲਤਾਨਪੁਰ ਨੂੰ ਜ਼ਿਆਦਾ ਟਾਈਮ ਨਹੀਂ ਲੱਗਦਾ ਕਪੂਰਥਲੇ ਤੋਂ ਸੁਲਤਾਨਪੁਰ ਦਾ ਰਸਤਾ ਸਿਰਫ ਅੱਧੇ ਘੰਟੇ ਦਾ ਵਾ ਹਾਂਜੀ ਇਹ ਸਾਰਾ ਸਾਡੇ ਕੰਪਨੀ ਦਾ ਖਰਚਾ ਹੁੰਦਾ ਵਾ ਇੱਕ ਵਾਰੀ ਜੇ ਤੁਸੀਂ ਸਾਡੇ ਵੈਬਸਾਈਟ 'ਤੇ ਜਾ ਕੇ ਰਜਿਸਟਰੇਸ਼ਨ ਕਰਤੀ ਤੁਹਾਡਾ ਸਾਰਾ ਕਿੱਥੇ ਤੁਸੀਂ ਰਹੋਗੇ ਕਿੱਦਾਂ ਜਾਓਗੇ ਸਾਰਾ ਤੁਹਾਡਾ ਖਰਚਾ ਹੁੰਦਾ ਵਾ ਹਾਂਜੀ ਤੁਸੀਂ ਮੈਨੂੰ ਇਸੇ ਇਸੇ ਨੰਬਰ 'ਤੇ ਵਟਸਐਪ 'ਤੇ ਆਪਣੀ ਸਾਰੀ ਡਿਟੇਲ ਔਰ ਆਪਣੀ ਫਰੈਂਡ ਦੀ ਆਧਾਰ ਕਾਰਡ ਵਗੈਰਾ ਪਲੀਜ਼ ਸਾਰਾ ਕੁਝ ਮੈਨੂੰ ਭੇਜ ਦਿਓ ਇਸੀ ਨੰਬਰ 'ਤੇ ਹਾਂਜੀ ਸਤਿ ਸ਼੍ਰੀ ਅਕਾਲ ਜੀ